ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਓਲਾ ਕੰਪਨੀ ਤੋਂ ਗੱਲ ਕਰ ਰਹੇ ਹੋ ਮੈਂ ਰਮਨਦੀਪ ਕੌਰ ਝੁੰਬੇ ਤੋਂ ਵੀਰੇ ਮੈਂ ਤੁਹਾਡੇ ਇੱਥੇ ਕੈਬ ਬੁੱਕ ਕੀਤੀ ਸੀ ਜੋ ਝੁੰਬੇ ਤੋਂ ਚੰਡੀਗੜ੍ਹ ਲਈ ਕੀਤੀ ਸੀ ਜਿਹਦਾ ਟਾਈਮਿੰਗ ਦਸ ਵਜੇ ਸੀ ਅਤੇ ਮੈਂ ਦਸ ਵਜੇ ਤੋਂ ਮੈਂ ਦੋ ਵਜੇ ਉੱਥੇ ਹਰ ਹਾਲਤ 'ਚ ਪਹੁੰਚਣਾ ਸੀ ਇਸ ਕਰਕੇ ਤੁਹਾਡੀ ਕੈਪ ਮੇਰੇ ਕੋਲ ਨਹੀਂ ਪਹੁੰਚੀ ਜਿਸ ਦਾ ਟਾਈਮ ਹੁਣ ਗਿਆਰ੍ਹਾਂ ਵੱਜ ਗਿਆ ਮੈਂ ਪੂਰਾ ਇੱਕ ਘੰਟਾ ਵੇਟ ਕੀਤੀ ਤੁਹਾਡੀ ਕੈਪ ਮੇਰੇ ਕੋਲ ਨਹੀਂ ਪਹੁੰਚੀ ਜਿਸ ਕਾਰਨ ਮੈਂ ਹੋਰ ਕੈਬ ਬੁੱਕ ਕਰ ਲਈ ਹੈ ਇਸ ਕਰਕੇ ਮੈਂ ਤੁਹਾਡੀ ਇਸ ਕੈਪ ਨੂੰ ਮਤਲਬ ਕੈਂਸਲ ਕਰਨਾ ਚਾਹੁੰਦੀ ਹਾਂ ਕਿ ਤੁਹਾਡੀ ਇਸ ਕੈਪ ਦੀ ਦੇਰੀ ਓ ਦੇਰੀ ਕਾਰਨ ਮੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਜਿਸ ਕਾਰਨ ਮੈਂ ਹਰ ਹਾਲਤ ਦੇ ਵਿੱਚ ਚੰਡੀਗੜ੍ਹ ਪਹੁੰਚਣਾ ਸੀ ਜੋ ਕਿ ਮੈਨੂੰ ਬਹੁਤ ਜ਼ਰੂਰੀ ਸੀ ਤੁਹਾਡੀ ਇਸ ਕੈਪ ਦੇ ਕਾਰਨ ਮੈਨੂੰ ਇੱਕ ਘੰਟਾ ਦੇਰੀ ਹੋਈ ਇਸ ਕਰਕੇ ਮੈਨੂੰ ਬਹੁਤ ਹੀ ਮੁਸ਼ਕਲਾਂ ਹੋਈਆਂ ਜਿਸ ਕਾਰਨ ਮੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਹੋਣ ਕਰਕੇ ਮੈਂ ਹੋਰ ਕੈਬ ਬੁੱਕ ਕੀਤੀ ਹੈ ਇਸ ਕਰਕੇ ਮੈਂ ਹੋਰ ਕੈਬ ਦੇ ਵਿੱਚ ਜਾ ਰਹੀ ਹਾਂ ਅਤੇ ਤੁਹਾਡੀ ਇਸ ਕੈਪ ਨੂੰ ਮੈਂ ਬੁੱਕ ਬੁੱਕ ਦੀ ਜਗ੍ਹਾ ਮੈਂ ਕੈਂਸਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਕੈਪ ਨੂੰ ਕੈਂਸਲ ਕਰੋ ਅਤੇ ਇਸ ਲਈ ਮੈਂ ਆਪਣੀ ਹੋਰ ਕੈਪ ਬੁੱਕ ਕਰ ਲਈ ਹੈ ਜਿਸ ਕਾਰਨ ਮੈਂ ਸਮੇਂ ਸਿਰ ਸ਼ਾਇਦ ਸਮੇਂ ਸਿਰ ਪਹੁੰਚ ਜਾਵਾਂਗੀ ਅਤੇ ਤੁਹਾਡੀ ਇਸ ਕੈਪ ਨੇ ਦਸ ਵਜੇ ਨਾ ਆਉਣ ਕਰਕੇ ਮੇਰੀਆਂ ਮੁਸ਼ਕਲਾਂ ਬਹੁਤ ਵਧਾ ਦਿੱਤੀਆਂ ਸਨ ਇਸ ਲਈ ਮੈਂ ਇਹ ਕੈਪ ਕੈਂਸਲ ਕਰਨਾ ਚਾਹੁੰਦੀ ਹਾਂ ਥੈਂਕ ਯੂ